ਸਮਾਰਟ ਫੋਨ ਦੇ ਕਾਰਨ ਮੈਂ ਘਰ ਬੈਠ ਕੇ ਖਬਰਾਂ ਦੇਖ ਸਕਦਾ ਹਾਂ ਅਤੇ ਗੀਤ ਸੁਣ ਸਕਦਾ ਹਾਂ ਅਤੇ ਹੋਰ ਵੀ ਬਹੁਤ ਹੈ ਜੋ ਸਰਕਾਰੀ ਕੰਮ ਕਰ ਸਕਦਾ ਪਹਿਲਾਂ ਮੈਨੂੰ ਖੁਦ ਜਾਣਾ ਪੈਂਦਾ ਸੀਗਾ ਪਰ ਅੱਜ ਕੱਲ੍ਹ ਹੁਣ ਮੇਰਾ ਸਾਰਾ ਕੰਮ ਘਰ ਬੈਠੇ ਹੀ ਮੇਰੇ ਫੋਨ 'ਤੇ ਹੋ ਜਾਂਦਾ ਹੈ